ਹਾਂ ਮੈਂ ਡਰ ਹਾਂ ਮੈਂ ਡਰਾਇੰਗ ਕਰਨ ਲਈ ਕੁਝ ਤਕਨੀਕਾਂ ਅਤੇ ਨੁਕਤੇ ਆਨਲਾਈਨ ਦੇਖੇ ਹਨ ਮੈਂ ਆਪਣੀ ਡਰਾਇੰਗ ਨੂੰ ਹੋਰ ਵਧੀਆ ਬਣਾਉਣ ਲਈ ਤਕਨੀਕਾਂ 'ਤੇ ਜਾਣਕਾਰੀ ਲੈਂਦੀ ਰਹਿੰਦੀ ਹਾਂ ਇੰਟਰਨੈਟ 'ਤੇ ਦੇਖਦੀ ਰਹਿੰਦੀ ਹਾਂ ਡਰਾਇੰਗ ਕਈ ਕਿਸਮਾਂ ਦੀ ਹੁੰਦੀ ਹੈ ਡਰਾਇੰਗ ਵਿੱਚ ਜਿਵੇਂ ਸ਼ਾਮਿਲ ਹੁੰਦੇ ਹਨ ਡਰਾਇੰਗ ਫਾਰਮ ਚਿੱਤਰ ਬਣਾਉਣ ਲਈ ਕਿਸੇ ਤਹਿਤ ਦਾ ਨਿਸ਼ਾਨ ਬਣਾਉਣ ਦਾ ਕੰਮ ਕਰਦੇ ਹਨ ਜ਼ਿਆਦਾਤਰ ਜ਼ਿਆਦਾਤਰ ਵਿੱਚ ਕਿਸੇ ਕਿਸੇ ਵੀ ਰੂਪ ਵਿੱਚ ਕਾਰਜ ਵਿੱਚ ਡਰਾਇੰਗ ਸ਼ਾਮਿਲ ਹੁੰਦੀ ਹੈ ਇਹ ਕਈ ਕਿਸਮਾਂ ਦੀ ਹੁੰਦੀ ਹੈ ਟੈਰੀਕੇਚ ਡਰਾਇੰਗ ਇਹ ਕੈਰੀਕੇਚ ਡਰਾਇੰਗ ਉਹ ਚਿੱਤਰ ਹੁੰਦੇ ਹਨ ਜੋ ਜੋ ਉਹਨਾਂ ਵਿਸ਼ਿਆਂ ਨੂੰ ਬਹੁਤ ਜ਼ਿਆਦਾ ਸਰਲ ਤਰੀਕਿਆਂ ਨਾਲ ਦਰਸਾਉਂਦੇ ਹਨ ਅਤੇ ਇਹਨਾਂ ਦੇ ਕੁਝ ਲੱਛਣ ਕਿਸੇ ਵੀ ਚਿਹਰੇ ਦੀ ਵਿਸ਼ੇਸ਼ਤਾਵਾਂ ਨੂੰ ਵਧਾਉਂਦਾ ਹੈ ਕਾਰਟੂਨ ਡਰਾਇੰਗ ਕਾਰਟੂਨ ਡਰਾਇੰਗ ਆਮ ਤੌਰ 'ਤੇ ਦੁਨੀਆਂ ਦੇ ਵਧੇਰੇ ਹਾਸਕ ਹਾਸਕ ਵਾਂਗ ਦਿਖਾਉਂਦੇ ਹਨ ਚਿਤਰਾਂ ਵਿੱਚ ਭਾਵਨਾਵਾਂ ਅਤੇ ਆਵਾਜ਼ਾਂ ਦਿਖਾਉਂਦੇ ਹਨ ਅਤੇ ਕਾਰਟੂਨ ਡਰਾਇੰਕ ਇਹਨਾਂ ਵਿੱਚ ਸ਼ਾਮਿਲ ਹੁੰਦੀ ਹੈ ਚਿੱਤਰ ਡਰਾਇੰਗ ਕਲਾਕਾਰ ਭੌਤਿਕ ਸੰਸਾਰ ਨਿਰੱਖਣ ਦੇ ਕਰਕੇ ਚਿੱਤਰ ਬਣਾਉਂਦੇ ਹਨ ਜਿਸ ਨੂੰ ਸਥਿਰ ਜੀਵ ਜੀਵਨ ਡਰਾਇੰਗ ਵੀ ਕਿਹਾ ਜਾਂਦਾ ਹੈ